ਹੈਲੋ ਹਾਂਜੀ ਸਤਿ ਸ਼੍ਰੀ ਆਕਾਲ ਜੀ ਹਾਂਜੀ ਤੁਸੀਂ ਪੰਜਾਬ ਆਰਟ ਗੈਲਰੀ ਤੋਂ ਨਵਦੀਪ ਕੌਰ ਗੱਲ ਕਰ ਰਹੇ ਹੋ ਹਾਂਜੀ ਮੈਂ ਤੁਹਾਡੀ ਗੈਲਰੀ ਬਾਰੇ ਬਹੁਤ ਸੁਣਿਆ ਹੈ ਹਾਂਜੀ ਤੁਸੀਂ ਪ੍ਰਸੰਸਾ ਦੇ ਬਹੁਤ ਪਾਤਰ ਹੋ ਜੋ ਪੰਜਾਬੀ ਵਿਸਤਰੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੈ ਹਾਂਜੀ ਹਾਂਜੀ ਅਤੇ ਤੁਹਾਡੇ ਮਤਲਬ ਕਿ ਗੈਲਰੀ ਦੇ ਵਿੱਚ ਆਪਣੀ ਇਹਦਾ ਨਾਮ ਕੀ ਆ ਪੁਰਾਣੇ ਲਹਿੰਗੇ ਜਿਵੇਂ ਚਰਖੇ ਅਤੇ ਪੱਖੀਆਂ ਆਦਿ ਵਗੈਰਾ ਸਾਰੇ ਰੱਖੇ ਹੋਏ ਆ ਜੇ ਅੱਜ ਕੱਲ੍ਹ ਹਾਂਜੀ ਅੱਜ ਕੱਲ੍ਹ ਦੀ ਜਨਰੇਸ਼ਨ ਇਸ ਬਾਰੇ ਮਤਲਬ ਕਿ ਕੋਈ ਜਾਣਦਾ ਹੀ ਨਹੀਂ ਇਹਨਾਂ ਨੂੰ ਹਾਂਜੀ ਭੁੱਲ ਚੁੱਕੇ ਆ ਬੱਚੇ ਵੀ ਭੁੱਲ ਚੁੱਕੇ ਆ ਵੱਡੇ ਵੀ ਭੁੱਲ ਚੁੱਕੇ ਆ ਇਸ ਬਾਰੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਅਸੀਂ ਆਵਾਂਗੇ ਤੁਹਾਡੀ ਗੈਲਰੀ ਦੇ ਵਿੱਚ ਹਾਂਜੀ ਹਾਂਜੀ ਹਾਂਜੀ ਤੁਸੀਂ ਸਾਡੇ ਕੋਲੋਂ ਖਰੀਦਣਾ ਚਾਹੁੰਦੇ ਜੇਕਰ ਮੇਰੇ ਕੋਲ ਵੀ ਪੁਰਾਣੇ ਲਹਿੰਗੇ ਜਿਵੇਂ ਸਾਡੇ ਬਜ਼ੁਰਗਾਂ ਦੇ ਪਏ ਆ ਲਹਿੰਗੇ ਚਰਖੇ ਪੀੜੀਆਂ ਪ੍ਰਾਂਦੇ ਸਾਰਾ ਕੁਝ ਮਤਲਬ ਕਿ ਪਿਆ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਅਸੀਂ ਆਵਾਂਗੇ ਤੁਹਾਡੇ ਕੋਲ ਬਹੁਤ ਜਲਦ ਫਿਰ ਆ ਕੇ ਆਪਾਂ ਮਤਲਬ ਰੇਟ ਵਗੈਰਾ ਆਪਾਂ ਉਹ ਕਰਲਾਂਗੇ ਡਿਸਾਇਡ ਹਾਂਜੀ ਓਕੇ ਜੀ ਚੰਗਾ ਸਤਿ ਸ਼੍ਰੀ ਅਕਾਲ